ਨੌਜਵਾਨ ਪੀੜੀ ਸੱਭਿਆਚਾਰ ਰੀਤਾਂ ਦੀ ਸਖ਼ਤੀ ਨਾਲ ਪਾਲਣਾ ਜੇ ਕਰਦੀ ਹੋਵੇ ਤਾਂ ਅੱਜ ਸਮਾਜ ਦੇ ਵਿੱਚ ਇਹ ਜੋ ਕੁਛ ਵੀ ਚੱਲ ਰਿਹਾ ਇਹ ਹੋਣਾ ਨਹੀਂ ਸੀ ਉਹਨਾਂ ਦੀ ਪਲਾਣਾ ਨਹੀਂ ਕਰਦੀ ਵੱਡੇ ਬਜ਼ੁਰਗਾਂ ਨੇ ਜੋ ਵੀ ਸਿੱਖਿਆ ਦਿੱਤੀ ਹੈ ਉਹਨਾਂ ਦੀ ਪਾਲਣਾ ਨਹੀਂ ਕਰਦੇ ਹੈਗੇ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਚਰਨਾ ਹੈਗਾ ਉਹਨਾਂ ਨੂੰ ਨਹੀਂ ਪਤਾ ਵੀ ਹਾਂ ਅਸੀਂ ਆਪਣੇ ਤੋਂ ਵੱਡਿਆਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਆ ਕਿਵੇਂ ਅਸੀਂ ਰਿਸ਼ਤੇਦਾਰੀਆਂ ਨਿਭਾਉਣੀਆਂ ਨੇਗੀਆਂ ਸਾਰਾ ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ ਸਿਰਫ ਇਹ ਆ ਵੀ ਹਾਂ ਪੈਸਾ ਆਉਂਦਾ ਅਸੀਂ ਕੰਮ ਕਰਦੇ ਹਾਂ ਪੈਸਾ ਕਮਾਉਂਦੇ ਖਾਂਦੇ ਹਾਂ ਪੀਂਦੇ ਹਾਂ ਬਸ ਕੋਈ ਮਤਲਬ ਨਹੀਂ ਅਸੀਂ ਕਿਸੇ ਨਾਲ ਵਧੀਆ ਤਰੀਕੇ ਨਾਲ ਮਿਲਣਾ ਵਰਤਣਾ ਨਹੀਂ ਹੈਗਾ ਪਹਿਲਾਂ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਨੂੰ ਸਾਰਾ ਕੁਛ ਪਤਾ ਹੁੰਦਾ ਸੀ ਕਿਵੇਂ ਮਿਲਣਾ ਵਰਤਣਾ ਹੈਗਾ ਉਹਨਾਂ ਨੇ ਬਾਕੀ ਸਮਾ ਸਮਾਜ ਦੇ ਵਿੱਚ ਮਿਲਣਾ ਵਰਤਣਾ ਕਿਸ ਤਰ੍ਹਾਂ ਆ ਆਪਣੇ ਰਿਸ਼ਤੇਦਾਰਾਂ ਨਾਲ ਕਿਵੇਂ ਵਰਤਣਾ ਹੈ ਤਾਂ ਜੋ ਸਾਡੇ ਦੁੱਖ 'ਚ ਸੁੱਖ ਦੇ ਵਿੱਚ ਸਾਥ ਰਹਿਣ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸੱਭਿਆਚਾਰ ਕਦਰਾਂ ਕੀਮਤਾਂ ਢਿੱਲੀਆਂ ਪੈ ਰਹੀਆਂ ਨੇ ਉਹਨਾਂ ਨੂੰ ਪਕੜਨ ਦੀ ਬਹੁਤ ਲੋੜ ਹੈ ਮਤਲਬ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਕੁੜੀਆਂ ਨੂੰ ਮਿਲ ਕੇ ਹ ਮਿਲ ਕੇ ਆਪਣੇ ਸਮਾਜ ਨੂੰ ਸੁਧਾਰਨ ਵਿੱਚ ਬਹੁਤ ਹੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਉਹਨਾਂ ਨੂੰ ਸੱਭਿਆਚਾਰ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਹੋਲੀ ਹੋਲੀ ਆਉਣ ਦੇ ਟਾਈਮ ਦੇ ਨਾਲ ਕੀ ਹੋਈ ਜਾਂਦਾ ਵੀ ਜਿਹੜੀਆਂ ਸਮਾਜ ਦੀਆਂ ਕਦਰਾਂ ਕੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੇ ਉਹ ਢਿੱਲੀਆਂ ਪੈ ਰਹੀਆਂ ਨੇ ਬੱਚਿਆਂ ਨੂੰ ਨਹੀਂ ਪਤਾ ਵੀ ਹਾਂ ਸਾਡਾ ਸੱਭਿਆਚਾਰ ਕਿਵੇਂ ਦਾ ਸੀ ਹੁਣ ਕਿਵੇਂ ਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਦੋ ਸਾਲਾਂ ਤੱਕ ਇਹ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਬਿਲਕੁਲ ਹੀ ਘੱਟ ਜਾਣੀਆਂ ਨੇਗੀਆਂ ਇਸ ਲਈ ਇਸ ਵੱਲ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਸੱਭਿਆਚਾਰ ਨਾਲ ਜੁੜੇ ਰਹਿਣ ਦੇ ਯਤਨਾਂ ਨੂੰ ਯਤਨ ਕਰਨੇ ਚਾਹੀਦੇ ਹਨ